ਹੈਲੋ ਹਾਂਜੀ ਸਿੰਧੀ ਸਵੀਟ ਤੋਂ ਬੋਲ ਹੋ ਰਹੇ ਹੈ ਜੀ ਸਰ ਇੱਕ ਔਡਰ ਸੀਗਾ ਜਿਸ ਵਿੱਚ ਇੱਕ ਕਿਲੋ ਗੁਲਾਬ ਜਾਮੁਨ ਵੀਹ ਪੀਸ ਸਮੋਸੇ ਅਤੇ ਦੋ ਬੋਤਲਾਂ ਜੋ ਹਨ ਉਹ ਕੋਲਡ ਡਰਿੰਕ ਦੀਆਂ ਦੀ ਅ ਚਾਹੀਦੀਆਂ ਹਨ ਕਿਰਪਾ ਕਰਕੇ ਜਿਹੜਾ ਔਡਰ ਹੈ ਉਹ ਮੇਰੇ ਆਫਿਸ ਦੇ ਐਡਰੈਸ 'ਤੇ ਭੇਜਣ ਦੀ ਖੇਚਲ ਕਰਨੀ ਜੀ ਮੇਰਾ ਜੋ ਐਡਰੈਸ ਹੈ ਉਹ ਫੇਸ ਅੱਠ ਦੇ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਾਲ ਹੀ ਹੈ ਜਿਸ ਆਪ ਜੀ ਨੂੰ ਫੋਨ ਨੰਬਰ ਮੈਂ ਸੈਂਡ ਕਰ ਰਿਹਾ ਕਿਰਪਾ ਕਰਕੇ ਮੇਰਾ ਜਿਹੜਾ ਔਡਰ ਹੈ ਉਹ ਮੇਰੇ ਐਡਰੈਸ 'ਤੇ ਭੇਜਣ ਦੀ ਕ੍ਰਿਪਾਲਤਾ ਕਰ